ਇੱਕ ਹਜ਼ਾਰ ਪੰਜ ਸੌ ਚਾਰ ਦੋ ਹਜ਼ਾਰ ਤਿੰਨ ਸੌ ਚਾਰ ਚਾਰ ਹਜ਼ਾਰ ਅੱਠ ਸੌ ਚਾਰ ਪੰਜ ਹਜ਼ਾਰ ਛੇ ਸੌ ਚਾਰ ਨੌ ਹਜ਼ਾਰ ਦੋ ਸੌ ਚਾਰ